ਜਿਵੇਂ ਕਿ ਤੁਸੀਂ ਦੇਖਿਆ ਆ ਪੰਜਾਬ ਵਿੱਚ ਸਿੱਖਿਆ ਖੇਤਰ ਵਿੱਚ ਕੰਮ ਕਰਨ ਦੇ ਬਹੁਤ ਹੀ ਮੌਕੇ ਮਿਲਦੇ ਹਨ ਜੇਕਰ ਅਸੀਂ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਕੰਮ ਕਰਨਾ ਚਾਹੁੰਦੇ ਹੈਗੇ ਹਾਂ ਤਾਂ ਸਾਨੂੰ ਉਸ ਤੋਂ ਪਹਿਲਾਂ ਇੱਕ ਟੈਸਟ ਕਲੀਅਰ ਕਰਨਾ ਪੈਂਦਾ ਹੈਗਾ ਹੈ ਜੇ ਅਸੀਂ ਉਸ ਟੈਸਟ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਕਲੀਅਰ ਕਰਦੇ ਹਾਂ ਤਾਂ ਸਾਨੂੰ ਪੰਜਾਬ ਦੇ ਸਿੱਖਿਆ ਖੇਤਰ ਦੇ ਵਿੱਚ ਬਹੁਤ ਹੀ ਕੰਮ ਕਰਨ ਦੇ ਮੌਕੇ ਮਿਲਦੇ ਹਨ ਇਹ ਮੌਕੇ ਹਰ ਕਿਸੇ ਨੂੰ ਨਹੀਂ ਮਿਲਦੇ ਹਨ ਇਹ ਮੌਕੇ ਸਿਰਫ ਉਹਨਾਂ ਨੂੰ ਹੀ ਦਿੱਤੇ ਜਾਂਦੇ ਹਨ ਜਿਹੜੇ ਕਿ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਬਾਅਦ ਪੇਪਰ ਕਲੀਅਰ ਕਰਨ ਤੋਂ ਬਾਅਦ ਹੀ ਇਹ ਮੌਕਾ ਮਿਲਦਾ ਹੈ ਜੇਕਰ ਅਸੀਂ ਆਪਣਾ ਪੇਪਰ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਕਲੀਅਰ ਕਰਦੇ ਹੈਗੇ ਹਾਂ ਤਾਂ ਅਸੀਂ ਆਪਣੇ ਅੱਗੇ ਜਾ ਕੇ ਜਿਹੜੇ ਵੀ ਕ ਪੰਜਾਬ ਦੇ ਸਿੱਖਿਆ ਖੇਤਰ ਦੇ ਕੰਮ ਹੈਗੇ ਆ ਉਹ ਕਰ ਸਕਦੇ ਹੈਗੇ ਹਾਂ ਜੇਕਰ ਅਸੀਂ ਆਪਣਾ ਕੋਈ ਵੀ ਪੇਪਰ ਭਰਦੇ ਹੈਗੇ ਹਾਂ ਤਾਂ ਸਾਨੂੰ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਤਿਆਰੀ ਕਰਨੀ ਚਾਹੀਦੀ ਹੈਗੀ ਹੈ ਅਤੇ ਫਿਰ ਹੀ ਉਹ ਪੇਪਰ ਨੂੰ ਦੇਣਾ ਚਾਹੀਦਾ ਹੈ ਜੇ ਅਸੀਂ ਬਿਨਾ ਤਿਆਰੀ ਤੋਂ ਉਸ ਪੇਪਰ ਨੂੰ ਦਿੰਦੇ ਹਾਂ ਤਾਂ ਸਾਡਾ ਪੇਪਰ ਦੇਣ ਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਕਿਉਂਕਿ ਬਹੁਤ ਹੀ ਉਹਦੇ ਵਿੱਚ ਕੋਂਪੀਟੀਸ਼ਨ ਬਹੁਤ ਹੀ ਜ਼ਿਆਦਾ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਪੇਪਰ ਭਰਿਆ ਹੁੰਦਾ ਹੈਗਾ ਹੈ ਇਸ ਕਰਕੇ ਸਾਨੂੰ ਕੋਈ ਵੀ ਪੇਪਰ ਦੇਣ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਤਿਆਰੀ ਕਰਨੀ ਚਾਹੀਦੀ ਆ ਜੇ ਅਸੀਂ ਇਹ ਪੰਜਾਬ ਦੇ ਸਿੱਖਿਆ ਖੇਤਰ ਵਾਲਾ ਪੇਪਰ ਕਲੀਅਰ ਕਰ ਲੈਂਦੇ ਹੈਗੇ ਹਾਂ ਤਾਂ ਸਾਨੂੰ ਅੱਗੇ ਜਾ ਕੇ ਇਸ ਦੀਆਂ ਬਹੁਤ ਸਾਰੀਆਂ ਫੈਸਿਲਿਟੀਜ਼ ਵੀ ਮਿਲਦੀਆਂ ਹੈਗੀਆਂ ਆਂ ਜਿਹੜੀਆਂ ਕਿ ਸਾਡੇ ਅਤੇ ਸਾਡੇ ਪਰਿਵਾਰ ਲਈ ਬਹੁਤ ਵਧੀਆ ਹੁੰਦੀਆਂ ਹੈਗੀਆਂ ਆਂ